ਐਸਕਿਊਜ਼ ਮੀ ਭਾਅ ਜੀ ਮੈਂ ਇਹ ਪੁੱਛਣਾ ਸੀਗਾ ਕਿ ਆਪਾਂ ਇੱਥੋਂ ਮੈਕਸੀਮਮ ਸਾਨੂੰ ਹੋਈ ਗਿਆ ਕਿ ਪੰਜ ਜਾਂ ਦਸ ਮਿੰਟ ਹੋ ਗਏ ਸਾਨੂੰ ਇੱਥੇ ਖੜ੍ਹਿਆਂ ਨੂੰ ਅਤੇ ਗਾ ਮੈਂ ਅੱਗੇ ਮੀਟਿੰਗ 'ਚ ਵੀ ਜਾਣਾ ਸੀਗਾ ਜਿਹਦਾ ਕਿ ਮੈਨੂੰ ਥੋੜ੍ਹਾ ਜਲਦੀ ਆ ਅਤੇ ਤੁਸੀਂ ਆਪਣੇ ਫ਼ੋਨ 'ਤੇ ਮੈਪ 'ਤੇ ਚੈੱਕ ਕਰ ਲਓ ਇੱਕ ਵਾਰੀ ਕਿ ਹੋਰ ਕੋਈ ਰਸਤਾ ਹੈ ਜਾਂ ਫਿਰ ਟ੍ਰੈਫਿਕ 'ਚੋਂ ਨਿਕਲ ਨੂੰ ਇਹਦਾ ਤਾਂ ਮੈਂ ਆਪਣੇ ਮੈਪ ਫ਼ੋਨ 'ਤੇ ਦੇਖਿਆ ਸੀਗਾ ਕਿ ਇੱਧਰੋਂ ਸਾਨੂੰ ਫਲਾਈ ਓਵਰ ਲਵਾਂਗੇ ਅਤੇ ਸਾਨੂੰ ਮਤਲਬ ਕਿ ਛੇਤੀ ਵੀ ਪਹੁੰਚ ਜਾਂਗੇ ਨਾਲੇ ਸ਼ੋਟਕੱਟ ਰਸਤਾ ਹੋ ਜਾਏਗਾ ਥੋੜ੍ਹਾ ਕਿਉਂਕਿ ਭਾਅ ਜੀ ਮੇਰੀ ਇੰਪੋਟੈਂਟ ਮੀਟਿੰਗ ਹੈ ਅਤੇ ਮੈਨੂੰ ਥੋੜ੍ਹਾ ਜਲਦੀ ਜਾਣਾ ਵੀ 'ਚ ਜਾਣਾ ਏ